ਪੰਜਾਬ ਵਿੱਚ ਰੋਜ਼ਾਨਾ ਜੀਵਨ ਨੂੰ ਨਿਯੰਤਰਿਤ ਕਰਨ ਵਾਸਤੇ ਬਹੁਤ ਕਾਨੂੰਨ ਬਣਾਏ ਗਏ ਹਨ ਜਿੱਦਾਂ ਕਿ ਹਿੰਦੂ ਮੈਰਿਜ ਐਕਟ ਜੋ ਕਿ ਪੰਜਾਬ ਵਿੱਚ ਵੀ ਅਪਲਾਈ ਹੁੰਦਾ ਹੈ ਉਸ ਵਿੱਚ ਸਾਰੇ ਵਿਆਹ ਬਾਰੇ ਵਿਆਹ ਅਤੇ ਉਸਦੇ ਨਾਲ਼ ਸੰਬੰਧਿਤ ਕਾਨੂੰਨਾਂ ਬਾਰੇ ਦੱਸਿਆ ਗਿਆ ਹੈ ਕਿੱਦਾਂ ਵਿਆਹ ਹੋਵੇਗਾ ਅਤੇ ਕਿਹੜਾ ਵਿਆਹ ਵੈਲਿਡ ਮੰਨਿਆ ਜਾਵੇਗਾ ਉਸ ਬਾਰੇ ਇਸ ਕਾਨੂੰਨ ਵਿੱਚ ਦੱਸਿਆ ਗਿਆ ਹੈ ਡਿਵੋਰਸ ਕਿੱਦਾਂ ਹੋਵੇਗਾ ਅਤੇ ਬੱਚੇ ਕਿਸ ਕੋਲ ਜਾਣਗੇ ਇਹ ਸਭ ਵੀ ਇਸ ਕਾਨੂੰਨ ਵਿੱਚ ਦੱਸਿਆ ਗਿਆ ਹੈ ਇੱਕ ਹੋਰ ਕਾਨੂੰਨ ਹੈ ਜਿਹੜਾ ਹੈ ਇੰਡੀਅਨ ਪੀਨਲ ਕੋਡ ਜਾਂ ਫਿਰ ਆਈ ਪੀ ਸੀ ਜੋ ਕਿ ਸਭ ਤੋਂ ਮਹੱਤਵਪੂਰਨ ਕਾਨੂੰਨ ਹੈ ਅਤੇ ਉਹ ਪੂਰੇ ਦੇਸ਼ ਵਿੱਚ ਨਿਯੁਕਤ ਹੁੰਦਾ ਹੈ ਇਸ ਵਿੱਚ ਸਾਰੇ ਬੇਸਿਕ ਕਾਨੂੰਨ ਹਨ ਅਤੇ ਲੋਕਾਂ ਨੂੰ ਆਪਣਾ ਜੀਵਨ ਜਿਉਣ ਅਤੇ ਭਾਰਤ ਵਿੱਚ ਰਹਿਣ ਬਾਰੇ ਬਾਰੇ ਹਰੇਕ ਕਾਨੂੰਨ ਦੱਸਿਆ ਗਿਆ ਹੈ ਕਿਸੇ ਵੀ ਕੋਈ ਵੀ ਬੰਦਾ ਜੇ ਕੋਈ ਕਾਨੂੰਨ ਤੋੜਦਾ ਹੈ ਤਾਂ ਉਸਨੂੰ ਕਿਹੜੀ ਪੁਨਿਸ਼ਮੈਂਟ ਦਿੱਤੀ ਜਾਵੇਗੀ ਇਹ ਵੀ ਇਸੇ ਆਈ ਪੀ ਸੀ ਵਿੱਚ ਅਤੇ ਕਾਨੂੰਨਾਂ ਵਿੱਚ ਲਿਖਿਆ ਗਿਆ ਹੈ ਮੋਟਰ ਵਹੀਕਲ ਐਕਟ ਸਾਰੇ ਮੋਟਰ ਵਹੀਕਲਾਂ ਕਾਰਾਂ ਮੋਟਰਸਾਈਕਲਾਂ ਦੇ ਵੇਚਣ ਅਤੇ ਖਰੀਦਣ ਦੇ ਸਾਰੇ ਕਾਨੂੰਨ ਵਿੱਚ ਲਿਖੇ ਗਏ ਹਨ ਅਤੇ ਉਸ ਸਭ ਨੂੰ ਇਹ ਮੈਨੇਜ ਕਰਦਾ ਹੈ